ਇੱਕ ਵਾਰ ਦੀ ਗੱਲ ਹੈ ਕਿ ਮੈਂ ਸੋਚਿਆ ਕਿ ਕੁਝ ਔਨਲਾਈਨ ਸ ਔਨਲਾਈਨ ਖਰੀਦ ਕੀਤ ਦਾਰੀ ਕੀਤੀ ਜਾਵੇ ਤਿਉਹਾਰਾਂ ਦੇ ਦਿਨ ਸਨ ਅਤੇ ਮੈਂ ਔਫਰ ਵੀ ਵਧੀਆ ਚੱਲ ਰਹੇ ਸਨ ਅਤੇ ਮੈਂ ਔਨਲੈਨ ਕੁਰਸੀਆਂ ਆਡਰ ਕੀਤੀਆਂ ਆਡਰ ਤਾਂ ਕਰ ਦਿੱਤੀਆਂ ਪਰ ਮੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੋ ਮੈਂ ਔਡਰ ਕੀਤ ਔਡਰ ਕੀਤਾ ਸੀ ਉਹ ਸੀਮਿਤ ਸਮੇਂ ਤੋਂ ਕਾਫੀ ਟਾਈਮ ਬਾਅਦ ਆਇਆ ਉਦੋਂ ਨੂੰ ਤਿਉਹਾਰ ਵੀ ਸਾਰੇ ਲੰਘ ਚੁੱਕੇ ਸਨ ਅਤੇ ਜਦੋਂ ਘਰ ਕੁਰਸੀਆਂ ਆਈਆਂ ਤਾਂ ਦੇਖਿਆ ਕਿਮ ਕਿ ਮਟੀਰੀਅਲ ਬਹੁਤ ਰੱਦੀ ਟੈਪ ਦਾ ਰੱਦੀ ਟੈਪ ਸੀ ਰੱਦੀ ਟੈਪ ਹੈ ਕੁਝ ਜਗ੍ਹਾ ਤੋਂ ਰੰਗ ਵੀ ਉਤਰਿਆ ਪਿਆ ਸੀ ਜੋ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆਈ ਅਤੇ ਮੈਂ ਅੱਜ ਤੋਂ ਕਦੇ ਵੀ ਔਨਲੈਨ ਸ਼ੋਪਿੰਗ ਨਹੀਂ ਕੀਤੀ ਹਮੇਸ਼ਾ ਕਿਸੇ ਚੰਗੀ ਦੁਕਾਨ ਤੋਂ ਫਰਨੀਚਰ ਲੈਂਦਾ ਹਾਂ